ਪੰਜਾਬ ਵਿੱਚ ਵਸਦੇ ਲੋਕ ਜ਼ਿਆਦਾਤਰ ਖੁੱਲ੍ਹੇ ਘਰਾਂ ਵਿੱਚ ਰਹਿਣਾ ਪਸੰਦ ਕਰਦੇ ਹਨ ਇੱਥੋਂ ਦੇ ਘਰ ਪਹਿਲਾਂ ਦੇ ਮੁਕਾਬਲੇ ਹੁਣ ਪੱਕੇ ਹਾਂ ਇੱਟਾਂ ਦੇ ਬਣੇ ਹੋਏ ਹਨ ਪੰਜਾਬ ਦਾ ਜਲੰਧਰ ਦਾ ਏਰੀਆ ਸਭ ਤੋਂ ਵੱਧ ਜਨਸੰਖਿਆ ਵਾਲਾ ਏਰੀਆ ਹੈ ਕਿਉਂਕਿ ਉੱਥੋਂ ਦੇ ਜਨਸੰਖਿਆ ਜ਼ਿਆਦਾ ਹੋਣ ਕਰਕੇ ਉੱਥੋਂ ਦੇ ਬੱਤੀ ਕਿਲੋਮੀਟਰ ਦੇ ਹਿਸਾਬ ਨਾਲ ਜਨਸੰਖਿਆ ਵੀ ਜ਼ਿਆਦਾ ਹੈ